ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਖੇਡਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ ਹੈ ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ ਮਨੁੱਖ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਕੋਈ ਨਾ ਕੋਈ ਖੇਡ ਖੇਡਦਾ ਆਇਆ ਹੈ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ ਖੇਡਾਂ ਮਨੋਰੰਜਨ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵਧੀਆ ਸਾਧਨ ਹਨ ਖੇਡਾਂ ਮਨੁੱਖ ਲਈ ਓਨੀਆਂ ਹੀ ਜ਼ਰੂਰੀ ਹਨ ਜਿੰਨਾ ਕਿ ਮਨੁੱਖ ਲਈ ਹਵਾ ਅਤੇ ਪਾਣੀ ਹੈ ਇਹ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਬੱਚੇ ਦੇ ਜਨਮ ਤੋਂ ਲੈ ਕੇ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ ਇਹ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਸ਼ਕਤੀ ਦਿੰਦੀਆਂ ਹਨ ਸਿੱਖਣ ਪ੍ਰਕਿਰਿਆ ਛੋਟੇ ਹੁੰਦਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰੇ ਅਤੇ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੋ ਸਕਣ ਜ਼ਿੰਦਗੀ ਵਿੱਚ ਸਫ਼ਲ ਹੋਣ ਦੇ ਲਈ ਗਿਆਨ ਦੇ ਨਾਲ ਨਾਲ ਸਾਡੇ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਜ਼ਿੰਦਗੀ ਵਿੱਚ ਖੇਡਾਂ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਸੀਂ ਖੇਡਾਂ ਖੇਡਦੇ ਹਾਂ ਮੈਂ ਖੁਦ ਫੁੱਟਬਾਲ ਖੇਡਦੀ ਹਾਂ ਮੈਂ ਫਾਈਨਲ ਤੱਕ ਖੇਡ ਚੁੱਕੀ ਹਾਂ ਮੈਂ ਅਤੇ ਮੇਰੀ ਪੂਰੀ ਟੀਮ ਅਸੀਂ ਫਾਈਨਲ ਤੱਕ ਖੇਡ ਚੁੱਕੇ ਹਾਂ ਅਤੇ ਅਸੀਂ ਇਸ ਵਿੱਚ ਟਰੋਫੀ ਵੀ ਜਿੱਤ ਲਈ ਹੈ ਅਸੀਂ ਉੱਥੇ ਅ ਖੇਡਾਂ ਖੇਡੀਆਂ ਅਤੇ ਸਾਨੂੰ ਖੇਡਾਂ ਖੇਡਣ ਵਿੱਚ ਬਹੁਤ ਆਨੰਦ ਆਇਆ ਅਤੇ ਇਸ ਨਾਲ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੋਂ ਬਹੁਤ ਹੀ ਖੁਸ਼ ਰਹਿੰਦੇ ਹਾਂ ਖੇਡਣ ਦੇ ਨਾਲ ਅਸੀਂ ਟਰੋਫੀ ਵੀ ਜਿੱਤੀ ਫੁੱਟਬਾਲ ਖੇਡਣ ਲਈ ਬਹੁਤ ਹੀ ਜ਼ਰੂਰੀ ਹੈ ਦੌੜਨਾ ਜੇਕਰ ਅਸੀਂ ਦੌੜਾਂਗੇ ਨਹੀਂ ਤਾਂ ਸਾਡਾ ਸਟੈਮਨਾ ਨਹੀਂ ਬਣੇਗਾ ਅਤੇ ਅਸੀਂ ਫੁੱਟਬਾਲ ਜਾਂ ਹੋਰ ਕੋਈ ਵੀ ਖੇਡ ਨਹੀਂ ਖੇਡ ਸਕਦੇ ਮੈਂ ਅਤੇ ਮੇਰੀ ਪੂਰੀ ਟੀਮ ਅਸੀਂ ਹਰ ਰੋਜ਼ ਦੋ ਘੰਟੇ ਪ੍ਰੈਕਟਿਸ ਕਰਦੇ ਹਾਂ ਦੌੜਦੇ ਹਾਂ ਅਤੇ ਦੌ ਅਤੇ ਇਸ ਵਿੱਸ ਇਸ ਲਈ ਫੁੱਟਬਾਲ ਖੇਡਣ ਲਈ ਅਸੀਂ ਪ੍ਰੈਕਟਿਸ ਕਰਦੇ ਹਾਂ ਮੈਂ ਇੱਕ ਇਮਾਨਦਾਰ ਅਤੇ ਸਫ਼ਲ ਖਿਡਾਰਨ ਬਣਨਾ ਚਾਹੁੰਦੀ ਹਾਂ